ਹੈਲੋ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਅੱਛਾ ਜੀ ਕੁਛ ਸਪੈਸ਼ਲ ਕੰਮ ਬਾਰੇ ਜਾਂ ਕੋਈ ਇੱਦਾਂ ਸਮੁੱਚਾ ਹੀ ਦੱਸ ਦਈਏ ਵੈਸੇ ਤਾਂ ਜਿਹੜੀ ਸਰਕਾਰ ਵੱਲੋਂ ਕਾਫੀ ਕੁਝ ਉੱਥੇ ਹੋ ਰਿਹਾ ਡਿਵੈਲਪ ਕਾਫੀ ਹੋ ਰਿਹਾ ਸੜਕਾਂ ਬ ਬੜੀਆਂ ਵਧੀਆ ਬਣਾਈਆਂ ਪਾਣੀ ਦੀ ਸਪਲਾਈ ਬੜੀ ਅੱਛੀ ਹੈ ਅਤੇ ਹੋਰ ਵੀ ਸਰਕਾਰ ਅ ਕਈ ਕੰਮਾਂ ਨੂੰ ਪ੍ਰਮੋਟ ਕਰ ਰਹੀ ਹੈ ਅਤੇ ਬ ਜਿਹੜੀ ਗਲੀਆਂ ਨਾਲੀਆਂ ਦਾ ਸਾਡਾ ਕੰਮ ਬਹੁਤ ਵਧੀਆ ਆ ਅ ਨਾਲੀਆਂ ਸਾਰੀਆਂ ਢੱਕੀਆਂ ਹੋਈਆਂ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਵੀ ਇਹ ਜਿਹੜਾ ਸ਼ਹਿਰ ਸਾਡਾ ਸਵੱਛਤਾ ਦੇ ਵਿੱਚ ਫਸਟ ਆਇਆ ਸੀ ਅਤੇ ਇਸ ਕਰਕੇ ਜਿਹੜੀ ਸਥਾਨਕ ਪ੍ਰਬੰਧਕ ਹੈ ਉਹ ਵਧੀਆ ਇਹਨੂੰ ਵਧੀਆ ਤਰੀਕੇ ਦੇ ਨਾਲ ਲੈਂਦੇ ਆ ਤਾਂ ਕਿ ਅੱਗੇ ਤੋਂ ਵੀ ਅਸੀਂ ਫਸਟ ਆਈਏ ਹਰੇਕ ਪੱਖ ਤੋਂ ਜਿਹੜਾ ਉਹ ਵਧੀਆ ਤਰੀਕੇ ਦੇ ਨਾਲ ਡਿਵੈਲਪ ਹੋ ਹੋ ਰਿਹਾ ਸ਼ਹਿਰ ਔਰ ਲੋਕ ਬਹੁਤ ਸਾਰੇ ਹੁੰਦੇ ਆ ਆਲੋਚਨਾ ਕਰਨ ਵਾਲੇ ਵੀ ਪਰ ਫਿਰ ਵੀ ਕਿਸੇ ਗੱਲੋਂ ਘਬਰਾਉਣਾ ਨਹੀਂ ਚਾਹੀਦਾ ਬਹੁਤ ਸਾਰੀਆਂ ਸਕੀਮਾਂ ਸਰਕਾਰ ਦੀਆਂ ਜਿਹਨੂੰ ਬੜੇ ਅੱਛੇ ਤਰੀਕੇ ਨਾਲ ਪ੍ਰਬੰਧਕ ਜਿਹੜੇ ਆ ਉਹ ਕਰ ਰਹੇ ਆ ਬਹੁਤ ਵਧੀਆ ਆ ਕੋਈ ਘਬਰਾਉਣ ਵਾਲੀ ਗੱਲ ਨਹੀਂ ਅ ਤੁਸੀਂ ਆਪਣੇ ਪੇਪਰ ਦੇ ਵਿੱਚ ਜਾਂ ਚੈਨਲ ਦੇ ਵਿੱਚ ਬੜੇ ਨਿਧੜਕ ਹੋ ਕੇ ਲਿਖ ਸਕਦੇ ਹੋ ਕਿ ਸਾਡੇ ਸ਼ਹਿਰ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਹੈ ਬੜਾ ਅੱਛਾ ਹੈ ਬਹੁਤ ਵਧੀਆ ਪ੍ਰਬੰਧ ਹੈ